ਯੋਗਾ ਵਿੱਚ ਅਨੁਲੋਮ ਵਿਲੋਮ ਸਭ ਤੋਂ ਵਧੀਆ ਹੈ ਕਿਉਂਕਿ ਇਹਦੇ ਨਾਲ ਸਾਹ ਦੀਆਂ ਜਿਹੜੀਆਂ ਖੁੱਲ੍ਹੀ ਹਵਾਵਾਂ ਨੇ ਉਹ ਬਹੁਤ ਸਹੀ ਰਹਿੰਦੀਆਂ ਹਨ ਸਾਹ ਦੀ ਸਾਰੀ ਪ੍ਰੋਬਲਮਸ ਠੀਕ ਰਹਿੰਦੀਆਂ ਹਨ